ਮੈਂ ਇੱਕ ਸ਼ੈਂਪੂ ਦੀ ਮਸ਼ਹੂਰੀ ਦੇਖੀ ਸੀ ਜੋ ਕਿ ਤਕਰੀਬਨ ਸਾਰੇ ਚੈਨਲਾਂ 'ਤੇ ਆ ਰਹੀ ਸੀ ਇਸ ਸ਼ੈਪੂ ਦੇ ਬਹੁਤ ਹੀ ਫ਼ਾਇਦੇ ਦੱਸੇ ਜਾ ਰਹੇ ਸਨ ਅਤੇ ਰੇਟ ਵੀ ਬਜਟ ਦੇ ਅਨੁਸਾਰ ਬਹੁਤ ਹੀ ਘੱਟ ਦੱਸੇ ਜਾ ਰਹੇ ਸਨ ਇਸ ਦੀ ਵਰਤੋਂ ਲਈ ਹਫ਼ਤੇ ਵਿੱਚ ਦੋ ਵਾਰ ਦੱਸਿਆ ਗਿਆ ਸੀ ਅਤੇ ਸ਼ੈਂਪੂ ਉਹਨਾਂ ਲੋਕਾਂ ਦੇ ਲਈ ਸੀ ਜਿਨ੍ਹਾਂ ਦੇ ਸਿਰ ਦੇ ਵਿੱਚ ਸਿੱਕਰੀ ਸਫੈਦ ਵਾਲ ਅਤੇ ਝੜਦੇ ਵਾਲਾਂ ਦੀ ਸਮੱਸਿਆ ਦਾ ਕਾਫ਼ੀ ਜ਼ਿਕਰ ਕੀਤਾ ਹੋਇਆ ਸੀ ਅਤੇ ਮਸ਼ਹੂਰੀ ਨੂੰ ਦੇਖ ਕੇ ਮੈਂ ਬਹੁਤ ਪ੍ਰਭਾਵਿਤ ਹੋਈ ਕਿ ਇਹ ਇਹ ਪ੍ਰੋਡਕਟ ਨੂੰ ਮੰਗਵਾ ਕੇ ਵਰਤਣਾ ਚਾਹੀਦਾ ਹੈ ਇਹ ਪ੍ਰੋਡਕਟ ਉਹ ਔਨਲਾਈਨ ਵੇਚ ਰਹੇ ਸੀ ਜੋ ਕਿ ਮੈਂ ਅਤੇ ਮੇਰੀ ਇੱਕ ਦੋਸਤ ਨੇ ਇਕੱਠੇ ਹੀ ਅਸੀਂ ਔਨਲਾਈਨ ਔਡਰ ਕਰ ਦਿੱਤਾ ਜਦੋਂ ਇਹ ਔਨਲਾਈਨ ਔਡਰ ਕੀਤਾ ਤਾਂ ਉਸ ਉਹਨਾਂ ਨੇ ਹਫ਼ਤੇ ਦਾ ਡਿਲੀਵਰੀ ਟਾਈਮ ਦਿੱਤਾ ਹੋਇਆ ਸੀ ਪਰ ਜਦੋਂ ਡੈਲੀਵਰ ਹੋਇਆ ਅਤੇ ਘੱਟੋ ਘੱਟ ਇਹਨੂੰ ਪੰਦਰਾਂ ਵੀਹ ਦਿਨ ਉਹਨਾਂ ਨੇ ਲਗਾ ਦਿੱਤੇ ਅਤੇ ਜਦੋਂ ਅਸੀਂ ਆਪਣਾ ਔਨਲਾਈਨ ਜਿਹੜਾ ਆ ਔਡਰ ਉਹ ਮਤਲਬ ਰਿਸੀਵ ਕੀਤਾ ਅਤੇ ਉਸ ਦੇ ਵਿੱਚ ਸਾਨੂੰ ਡਿਲੀਵਰੀ ਚਾਰਜਿਸ ਦਾ ਕੋਈ ਪਤਾ ਨਹੀਂ ਸੀ ਕਿ ਇਹ ਫਰੀ ਹੈਗਾ ਹੈ ਕਿ ਜਾਂ ਮਤਲਬ ਵਿੱਚ ਤਾਂ ਉਹਨਾਂ ਨੇ ਡਿਲੀਵਰੀ ਜਿਹੜੀ ਏਜੰਟ ਹੁੰਦੇ ਉਹਨਾਂ ਨੇ ਸਾਡੇ ਕੋਲੋਂ ਦੋ ਸੌ ਰੁਪਏ ਐਕਸਟਰਾ ਲੈਣ ਦੀ ਮੰਗ ਕੀਤੀ ਜੋ ਕਿ ਸਾਨੂੰ ਦੇਣੇ ਪਏ ਸੈਂਪੂ ਵਰਤਣ ਤੋਂ ਬਾਅਦ ਅਸੀਂ ਦੇਖਿਆ ਕਿ ਇਹਦੀ ਜੋ ਐਕਸਪਾਇਰੀ ਉਹ ਵੀ ਖਤਮ ਹੋ ਚੁੱਕੀ ਸੀ ਜੋ ਕਿ ਔਨਲਾਈਨ ਏਜੰਸੀਆਂ ਵੱਲੋਂ ਲੋਕਾਂ ਨੂੰ ਬਹੁਤ ਠੱਗਿਆ ਜਾ ਰਿਹਾ ਅਤੇ ਇਹਦੇ ਕੋਈ ਜ਼ਿਆਦਾ ਫ਼ਾਇਦੇ ਵੀ ਨਹੀਂ ਸੀ ਲਾਉਂਦਿਆ ਸਾਰ ਹੀ ਮਤਲਬ ਵਾਲ ਉਸੇ ਤਰ੍ਹਾਂ ਹੀ ਝੜਨੇ ਰਹੇ ਅਤੇ ਸਫੈਦ ਵੀ ਹੋਣੇ ਮਤਲਬ ਬਣ ਨਹੀਂ ਰਹੇ ਇੱਕ ਵਾਰ ਅਸੀਂ ਸ਼ੈਂਪੂ ਯੂਸ ਕੀਤਾ ਮਤਲਬ ਹਫ਼ਤੇ 'ਚ ਉਹਨਾਂ ਨੇ ਦੋ ਵਾਰ ਕਿਹਾ ਸੀ ਪਰ ਸਾਡਾ ਮਤਲਬ ਵਧੀਆ ਰਿਜਲਟ ਨਾ ਆਉਣ ਕਰਕੇ ਅਸੀਂ ਇਸਨੂੰ ਦੁਬਾਰਾ ਯੂਸ ਨਹੀਂ ਕੀਤਾ ਇੱਕ ਚੀਜ਼ ਹੋਰ ਇਹਦੇ ਵਿੱਚ ਕਿ ਸ਼ੈਂਪੂ ਜਿਹੜਾ ਉਹਨਾਂ ਨੇ ਕੁਆਂਟਿਟੀ ਦੇ ਹਿਸਾਬ ਨਾਲ ਜੋ ਆ ਐਡ ਦੇ ਰਹੇ ਸੀ ਉਹਦੇ ਵਿੱਚ ਕੁਆਂਟਿਟੀ ਜ਼ਿਆਦਾ ਦੱਸ ਰਹੇ ਸੀ ਜੋ ਕਿ ਉਹਨਾਂ ਨੇ ਪ੍ਰੋਡਕਟ ਔਨਲਾਈਨ ਸਾਨੂੰ ਭੇਜਿਆ ਉਹਦੇ ਵਿੱਚ ਮ ਪੰਜ ਸੌ ਐੱਮ ਐੱਲ ਸੀ ਜੋ ਕਿ ਉਹ ਹਜ਼ਾਰ ਐੱਮ ਐੱਲ ਦਾ ਇੱਕ ਐੱਮ ਐੱਲ ਦਾ ਵੇਚ ਰਹੇ ਸੀ ਬਟ ਨਾਲ ਫਰੀ ਗਿਫਟ ਵੀ ਦੇ ਰਹੇ ਸੀ ਸਾਨੂੰ ਜੋ ਉਹ ਵੀ ਨਹੀਂ ਉਹਨਾਂ ਨੇ ਮਤਲਬ ਕੋਈ ਭੇਜਿਆ ਇਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਆਮ ਜਨਤਾ ਨੂੰ ਬਹੁਤ ਏਜੰਸੀਆਂ ਵਲੋਂ ਠੱਗਿਆ ਜਾ ਰਿਹਾ ਹੈ ਅਤੇ ਸਾਡੇ ਲਈ ਇਹ ਪ੍ਰੋਡਕਟ ਖਰੀਦਣਾ ਕੋਈ ਚੰਗੀ ਗੱਲ ਨਹੀਂ ਰਹੀ